ਮੇਰੇ ਪਿੰਡ ਵਿੱਚ ਮੇਰੇ ਗੁਆਂਡੀ ਦੀ ਲੱਤ 'ਤੇ ਇੱਕ ਕੁੱਤੇ ਨੇ ਕੱਟ ਲਿਆ ਜਿਸ ਦੇ ਬਾਰੇ ਪੂਰੀ ਜਾਣਕਾਰੀ ਨਹੀਂ ਸੀ ਕਿ ਉਹ ਕੁੱਤਾ ਪਾਗਲ ਹੈ ਜਾਂ ਮਤਲਬ ਠੀਕ ਹੈ ਇਸ ਕਾਰਨ ਲੱਤ ਉੱਪਰ ਹੋਏ ਜਖ਼ਮ ਨੂੰ ਪੱਟੀ ਕਰਕੇ ਉਸਨੂੰ ਹਸਪਤਾਲ ਪਹੁੰਚਾਇਆ ਗਿਆ ਜਿਸ 'ਤੇ ਡੋਕਟਰ ਨੇ ਜ ਜਖ਼ਮ ਨੂੰ ਸਾਫ਼ ਕਰਕੇ ਦੁਬਾਰਾ ਉਸਦੇ ਉੱਪਰ ਸਟਿਚ ਕਰਕੇ ਪੱਟੀ ਕੀਤੀ ਅਤੇ ਉਹ ਨਾਲ ਦਵਾਈਆਂ ਦਿੱਤੀਆਂ ਉਸ ਤੋਂ ਬਾਅਦ ਇਨਫੈਕਸ਼ਨ ਨਾ ਵਧੇ ਉਸਦੇ ਕਾਰਨ ਕੁਝ ਐਂਟੀਬੋਟੀ ਅਤੇ ਇੰਜੈਕਸ਼ਨ ਦਿੱਤੇ ਗਏ ਅਤੇ ਉਸ ਨੂੰ ਆਪਣੀ ਲੱਤ ਦੀ ਸਾਫ਼ ਸਫ਼ਾਈ ਦਾ ਦੱਸਿਆ ਗਿਆ ਜਿਸ ਦੇ ਨਾਲ ਉਸ ਨੂੰ ਚੱਲਣ ਫਿਰਨ ਥੋੜ੍ਹੀ ਦਿੱਕਤ ਆ ਰਹੀ ਸੀ ਉਸ ਤੋਂ ਬਾਅਦ ਲੋਕਾਂ ਦੀ ਹੈਲਪ ਦੇ ਨਾਲ ਉਸਨੂੰ ਉਸ ਦੇ ਘਰ ਪਹੁੰਚਾਇਆ ਗਿਆ ਅਤੇ ਅੱਗੇ ਤੋਂ ਪੂਰਾ ਸਾਵਧਾਨੀ ਨਾਲ ਚੱਲਣ ਲਈ ਖਿਆਲ ਰੱਖਣ ਲਈ ਅਤੇ ਪਿੰਡ ਵਿੱਚ ਕੁੱਤਿਆਂ ਦੀ ਜ਼ਿਆਦਾ ਨਫਰੀ 'ਤੇ ਪਾਬੰਦੀ ਲਗਾਉਣ ਦਾ ਹਸਪਤਾਲ ਨੂੰ ਮੈਸੇਜ ਦਿੱਤਾ ਗਿਆ